ਪੰਜਾਬ ਦੀ ਸੰਸਕ੍ਰਿਤੀ ਬਹੁਤ ਵਿਸ਼ਾਲ ਹੈ ਇੱਥੇ ਕਈ ਤਰ੍ਹਾਂ ਦੀ ਦੇ ਕਿੱਤੇ ਦੇ ਲੋਕ ਵੱਸਦੇ ਹੈ ਇੱਥੇ ਜ਼ਿਆਦਾਤਰ ਜਿਵੇਂ ਅਲੱਗ ਅਲੱਗ ਇਲਾਕਿਆਂ 'ਚ ਅਲੱਗ ਅਲੱਗ ਬੋਲੀ ਹੈ ਜਿਵੇਂ ਕਿ ਪੁਆਧ ਦੀ ਬੋਲੀ ਹੋ ਗਈ ਮਾਲਵੇ ਦੀ ਹੋ ਗਈ ਮਾਝੇ ਦੀ ਹੋ ਗਈ ਦੁਆਬੀ ਹੋ ਗਈ ਅਤੇ ਇਸ ਤਰ੍ਹਾਂ ਕਰਕੇ ਪੰਜਾਬ ਦੀ ਸੰਸਕ੍ਰਿਤੀ ਜਿਹੜੀ ਹੈਗੀ ਹੈ ਉਹ ਕਾਫੀ ਵਿਭਿੰਨਤਾਵਾਂ ਇਹਦੇ 'ਚ ਅਤੇ ਇਸ ਤਰ੍ਹਾਂ ਹੀ ਜਿਵੇਂ ਅਲੱਗ ਅਲੱਗ ਜਿਵੇਂ ਮੋਹਾਲੀ ਦਾ ਇਲਾਕਾ ਹੈਗਾ ਏ ਇਹਦੇ ਵਿੱਚ ਪੁਆਧ ਬ ਬੋਲਦੇ ਹੈ ਲੋਕੀ ਅਤੇ ਉੱਧਰ ਰੋਪੜ ਸਾਈਡ ਮਾਲਵਾ ਇਲਾਕਾ ਆ ਜਾਂਦਾ ਏ ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਲੋਕ ਇੱਥੇ ਬੋਲੀ ਬੋਲਦੇ ਨੇ